ਜਿਸ ਵਿਅਕਤੀ ਨੇ ਹੁਣੇ ਹੁਣੇ ਤੈਰਨਾਂ ਸਟਾਰਟ ਕੀਤਾ ਹੈ ਉਸਨੂੰ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਅਗਰ ਉਹ ਇਹ ਸਾਵਧਾਨੀਆਂ ਨਹੀਂ ਵਰਤੇਗਾ ਤਾਂ ਉਸਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾਂ ਪੈ ਸਕਦਾ ਹੈ ਸਭ ਤੋਂ ਪਹਿਲਾਂ ਉਸਨੂੰ ਚਾਹੀਦਾ ਹੈ ਕਿਸੇ ਚੰਗੇ ਤੈਰਾਕ ਕੋਲੋਂ ਤੈਰਨ ਸਬੰਧੀ ਜਾਣਕਾਰੀ ਲਵੇ ਫਿਰ ਉਹ ਜਿੱਥੇ ਤੈਰਨ ਦੀ ਪ੍ਰੈਕਟਿਸ ਕਰਦਾ ਹੈ ਅਤੇ ਉੱਥੇ ਲਾਗੇ ਕਿਸੇ ਹੈਲਪ ਕਰਨ ਵਾਲੇ ਇਨਸਾਨ ਦਾ ਜਾਂ ਕਿਸੇ ਗਾਈਡ ਦਾ ਹੋਣਾ ਬਹੁਤ ਜ਼ਰੂਰੀ ਹੈ ਬਿਨਾਂ ਗਾਈਡ ਜਾਂ ਬਿਨਾਂ ਹੈਲਪ ਵਾਲੇ ਇਨਸਾਨ ਦੀ ਮਜ ਗੈਰ ਮੌਜੂਦਗੀ ਦੇ ਵਿੱਚ ਅਗਰ ਉਹ ਤੈਰਨ ਦੀ ਪ੍ਰੈਕਟਿਸ ਕਰਦਾ ਹੈ ਤਾਂ ਇਹ ਜਾਨਲੇਵਾ ਹੋ ਸਕਦਾ ਹੈ ਉਸਨੂੰ ਚਾਹੀਦਾ ਹੈ ਕਿ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਜ਼ਿਆਦਾ ਡੂੰਘੇ ਪਾਣੀ ਦੇ ਵਿੱਚ ਨਾ ਜਾਵੇ ਥੋੜ੍ਹੇ ਘੱਟ ਪਾਣੀ ਦੇ ਵਿੱਚ ਜਿੱਥੇ ਆਪਣੇ ਆਪ ਨੂੰ ਸੰਭਾਲ ਸਕੇ ਉੱਥੇ ਤੈਰਨ ਦੀ ਪ੍ਰੈਕਟਿਸ ਕਰੇ ਜਦੋਂ ਘੱਟ ਪਾਣੀ ਦੇ ਵਿੱਚ ਉਹ ਤੈਰਨ ਦੇ ਵਿੱਚ ਸਫਲ ਰਹਿੰਦਾ ਹੈ ਤਾਂ ਪ੍ਰੈਕਟਿਸ ਕਰਨ ਤੋਂ ਬਾਅਦ ਹੀ ਉਸਨੂੰ ਡੂੰਘੇ ਪਾਣੀ ਦੇ ਵਿੱਚ ਜਾਣਾ ਚਾਹੀਦਾ ਹੈ ਕਦੇ ਵੀ ਕੋਈ ਸ਼ਰਾਰਤ ਦਾ ਮਾਹੌਲ ਜਾਂ ਇਸ ਤਰ੍ਹਾਂ ਦਾ ਕੁਛ ਨਹੀਂ ਕਰਨਾ ਚਾਹੀਦਾ ਜਿਸ ਦਾ ਉਹਨੂੰ ਕੋਈ ਨੁਕਸਾਨ ਉਠਾਣਾ ਪੈ ਸਕੇ